ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਵਲਜੀਤ ਕੌਰ ਹੈ ਮੈਂ ਤੁਹਾਨੂੰ ਅੱਜ ਤੋਂ ਦਸ ਦਿਨ ਪਹਿਲਾਂ ਇੱਕ ਕੈਬ ਬੁੱਕ ਕਰਨ ਲਈ ਫ਼ੋਨ ਕਰਿਆ ਸੀ ਜੀ ਮੈਂ ਤੁਹਾਨੂੰ ਉਹ ਹੀ ਯਾਦ ਕਰਵਾਉਣਾ ਚਾਹੁੰਦੀ ਹਾਂ ਕਿ ਮੈਂ ਆਪਣੀ ਫੈਮਿਲੀ ਨਾਲ਼ ਕੈਨੇਡਾ ਘੁੰਮਣ ਜਾ ਰਹੀ ਹਾਂ ਅਤੇ ਇਸ ਲਈ ਤੁਹਾਨੂੰ ਯਾਦ ਹੈ ਕਿ ਤੁਸੀਂ ਕੱਲ੍ਹ ਨੂੰ ਸਾਡੇ ਕੋਲ ਆਉਣਾ ਵੇ ਅਤੇ ਮੈਂ ਚਾਹੁੰਦੀ ਹਾਂ ਕਿ ਕੱਲ੍ਹ ਨੂੰ ਤੁਸੀਂ ਸਮੇਂ ਸਿਰ ਸਾਡੇ ਕੋਲ ਪਹੁੰਚੋ ਕਿਉਂਕਿ ਕੱਲ੍ਹ ਸਾਡਾ ਏਅਰਪੋਰਟ 'ਤੇ ਐਂਟਰੀ ਦਾ ਸਮਾਂ ਜਿਹੜਾ ਉਹ ਬਾਰ੍ਹਾਂ ਵਜੇ ਦੇ ਕਰੀਬ ਹੈ ਅਤੇ ਅਸੀਂ ਉਸ ਤੋਂ ਦੋ ਘੰਟੇ ਪਹਿਲਾਂ ਹੀ ਪਹੁੰਚਣਾ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਕੱਲ੍ਹ ਨੂੰ ਸਮੇਂ ਸਿਰ ਸਾਡੇ ਕੋਲ ਪਹੁੰਚੋ ਕਿਉਂਕਿ ਸਾਡੇ ਪਿੰਡ ਤੋਂ ਰੈਲ ਮਾਜਰੇ ਤੋਂ ਚੰਡੀਗੜ੍ਹ ਦੀ ਦੂਰੀ ਤਕਰੀਬਨ ਦੋ ਘੰਟੇ ਦੀ ਹੈ ਅਤੇ ਰਸਤੇ ਵਿੱਚ ਸੋਮਵਾਰ ਕਰਕੇ ਟ੍ਰੈਫ਼ਿਕ ਈਸ਼ੂਜ਼ ਵੀ ਹੋ ਸਕਦੇ ਨੇ ਅਤੇ ਜਿਹਦੇ ਕਰਕੇ ਕਿ ਮੈਂ ਕੋਈ ਵੀ ਪ੍ਰੋਬਲਮ ਨਹੀਂ ਚਾਹੁੰਦੀ ਕਿ ਮੈਂ ਚਾਹੁੰਦੀ ਹਾਂ ਕਿ ਹਰ ਕੰਮ ਜਿਹੜਾ ਉਹ ਸਮੇਂ ਸਿਰ ਹੋ ਜਾਵੇ ਅਤੇ ਇਸ ਲਈ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਪਲੀਜ਼ ਤੁਸੀਂ ਕੱਲ੍ਹ ਨੂੰ ਸਮੇਂ ਸਿਰ ਸਾਡੇ ਕੋਲ ਪਹੁੰਚਿਓ ਅਤੇ ਮੈਂ ਰਸਤੇ ਵਿੱਚ ਵੀ ਰੁਕਣਾ ਹੈ ਕੁਝ ਰਿਸ਼ਤੇਦਾਰ ਅਤੇ ਆਪਣੇ ਭਰਾ ਨੂੰ ਵੀ ਖਰੜ ਤੋਂ ਲੈਣਾ ਹੈ ਅਤੇ ਕੁਝ ਤੁਹਾਨੂੰ ਪਤਾ ਹੈ ਕਿ ਖਾਣ ਪੀਣ ਦਾ ਢਾਬੇ 'ਤੇ ਵੀ ਰੁਕਾਂਗੇ ਅਸੀਂ ਕੁਝ ਖਾਣ ਪੀਣ ਲਈ ਕਿ ਸਮੇਂ ਤੁਸੀਂ ਤੁਸੀਂ ਬਸ ਇਹ ਕਿ ਤੁਸੀਂ ਸਮੇਂ ਸਿਰ ਸਾਡੇ ਕੋਲ ਪਹੁੰਚਿਓ ਧੰਨਵਾਦ